ਮੈਂ ਅੱਜ ਸਵੇਰੇ ਉੱਠ ਕੇ ਆਪਣੇ ਮੋਬਾਇਲ ਦੀ ਜਦੋਂ ਵਰਤੋਂ ਕੀਤੀ ਅਤੇ ਮੈਨੂੰ ਇੰਜ ਮਹਿਸੂਸ ਹੋਇਆ ਕਿ ਮੇਰੇ ਮੋਬਾਈਲ ਦੀ ਜਿਹੜੀ ਇੰਟਰਨੈਟ ਦੀ ਸਪੀਡ ਹੈ ਉਹ ਬਹੁਤ ਹੀ ਹੌਲੀ ਚੱਲ ਰਹੀ ਹੈ ਅਤੇ ਮੈਨੂੰ ਇੰਝ ਲੱਗਿਆ ਕਿ ਸ਼ਾਇਦ ਮੇਰੇ ਮੋਬਾਈਲ ਦਾ ਡਾਟਾ ਜਿਹੜਾ ਉਹ ਸੀਮਾ ਤੱਕ ਪਹੁੰਚ ਗਿਆ ਜਾਂ ਖ਼ਤਮ ਹੋ ਗਿਆ ਫਿਰ ਮੈਂ ਆਪਣੇ ਮਤਲਬ ਮੋਬਾਇਲ ਆਪਰੇਟਰ ਨੂੰ ਦਾ ਨੰਬਰ ਡਾਇਲ ਕਰਕੇ ਉਹਨਾਂ ਨੂੰ ਪੁੱਛਿਆ ਅਤੇ ਉਹਨਾਂ ਨੂੰ ਆਪਣੀ ਇੰਟਰਨੈਟ ਦੀ ਸਪੀਡ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਮੈਂ ਆਪਣੇ ਡਾਟਾ ਦੀ ਵਰਤੋਂ ਦੀ ਜਾਂਚ ਕਰਨ ਦੀ ਬੇਨਤੀ ਕੀਤੀ